ਹੈਲੋ ਸਰ ਮੈਂ ਮੀਨਜ਼ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਹਾਂ ਉਸ ਪ੍ਰੋਡਕਟ ਬਾਰੇ ਜਿਹੜਾ ਪ੍ਰੋਡਕਟ ਮੈਂ ਤੁਹਾਡੇ ਕੋਲੋਂ ਮੰਗਵਾਇਆ ਸੀ ਐਕਚੁਲੀ ਮੈਂ ਤੁਹਾਡੇ ਕੋਲੋਂ ਆਪਣਾ ਰਸੋਈ ਵਾਸਤੇ ਕੁਛ ਕਰੋਕਰੀ ਦਾ ਸਮਾਨ ਮੰਗਵਾਇਆ ਸੀ ਅਤੇ ਇਹ ਪ੍ਰੋਡਕਟ ਬਹੁਤ ਜ਼ਿਆਦਾ ਅੱਛਾ ਰਿਹਾ ਹੈ ਇੱਕ ਤਾਂ ਮੀਨਜ਼ ਇਸਦੀ ਸ਼ਾਈਨਿੰਗ ਵਰਤਣ ਤੋਂ ਬਾਅਦ ਵੀ ਨਹੀਂ ਗਈ ਅਤੇ ਇੱਕ ਮੀਨਜ਼ ਬਿਲਕੁਲ ਅਨਬਰੇਕਵਲ ਹੈ ਇਹਦੀ ਟੁੱਟਣ ਵਗੈਰਾ ਦੀ ਕੋਈ ਦਿੱਕਤ ਨਹੀਂ ਆਈ ਅਤੇ ਜਿਹੜਾ ਉੱਪਰ ਪ੍ਰਿੰਟਿੰਗ ਵਗੈਰਾ ਚੰਗੀ ਤਰ੍ਹਾਂ ਹੋਈ ਪਈ ਸੀ ਉਸ ਤਰ੍ਹਾਂ ਹੀ ਆ ਕਈ ਵਾਰ ਧੋਣ ਤੋਂ ਬਾਅਦ ਵੀ ਉਹਦੀ ਸਾਈਨ ਨਹੀਂ ਗਈ ਔਰ ਨਾ ਹੀ ਉਸਦੇ ਉੱਪਰ ਕੋਈ ਵੀ ਦਾਲ ਸਬਜ਼ੀ ਦੇ ਹਲਦੀ ਵਗੈਰਾ ਦੇ ਜਿਵੇਂ ਆਮ ਕਰੋਕਰੀ ਦੇ ਸਮਾਨ 'ਤੇ ਦਾਗ ਧੱਬੇ ਬਣ ਜਾਂਦੇ ਆ ਇਵੇਂ ਕੁਛ ਵੀ ਨਹੀਂ ਬਣੇ ਮੈਂ ਮੀਨਜ਼ ਧੋਣ ਤੋਂ ਬਾਅਦ ਬਿਲਕੁਲ ਹੀ ਸਾਫ਼ ਨਵਿਆਂ ਵਰਗਾ ਚਮਕ ਜਾਂਦਾ ਸਾਰਾ ਸਮਾਨ ਅਤੇ ਮੀਨਜ਼ ਸਾਰੇ ਕਰੋਕਰੀ ਦਾ ਸਮਾਨ ਜਿੰਨਾਂ ਵੀ ਮੈਂ ਮੰਗਵਾਇਆ ਸੀ ਡਿਨਰ ਸੈਟ ਸਮੇਤ ਸਾਰਾ ਆਪਣੇ ਰਸੋਈ ਵਾਸਤੇ ਉਹ ਬਹੁਤ ਅੱਛਾ ਮੈਨੂੰ ਐਕਸਪੀਰੀਅੰਸ ਰਿਹਾ ਵਾ ਅਤੇ ਬਾਕੀ ਇਹਦੇ ਵਿੱਚ ਜਿੰਨਾ ਵੀ ਸਮਾਨ ਵਗੈਰਾ ਅਸੀਂ ਪਲੇਟਾਂ ਜਿਵੇਂ ਚਮਚ ਵਗੈਰਾ ਡੋਂਗੇ ਵਗੈਰਾ ਬਿਲਕੁਲ ਮੀਨਜ਼ ਪਰਫੈਕਟ ਨਿਕਲੇ ਆ ਅਤੇ ਜਿਹੜਾ ਉਹਨਾਂ ਦਾ ਸਾਈਜ਼ ਵੀ ਆ ਉਹ ਬਿਲਕੁਲ ਹੀ ਮੀਨਜ਼ ਅੱਛਾ ਹੈ ਨਾ ਤਾਂ ਜ਼ਿਆਦਾ ਵੱਡੇ ਨੇ ਅਤੇ ਨਾ ਜ਼ਿਆਦਾ ਛੋਟੇ ਨੇ ਅਤੇ ਬਿਲਕੁਲ ਚਮਚ ਦਾ ਸਾਈਜ਼ ਬਿਲਕੁਲ ਸਹੀ ਆ ਅਤੇ ਜਿਹੜੇ ਨਾਲ ਦੂਸਰੇ ਗਿਲਾਸ ਵਗੈਰਾ ਵੀ ਜਿਹੜੇ ਮਿਲੇ ਹੋਏ ਆ ਉਹ ਬਹੁਤ ਚੰਗੇ ਰਹੇ ਆ ਅਤੇ ਮੀਨਜ਼ ਕੋਈ ਸਾਨੂੰ ਸ਼ਿਕਾਇਤ ਨਹੀਂ ਆਈ ਤਾਂ ਮੈਂ ਬਹੁਤ ਧੰਨਵਾਦ ਕਰਦੀ ਹਾਂ ਇੰਨੀ ਚੰਗੀ ਚੀਜ਼ ਸਾਨੂੰ ਪ੍ਰੋਵਾਈਡ ਕਰਵਾਉਣ ਵਾਸਤੇ ਅਤੇ ਇਹੋ ਜਿਹੇ ਜਿਹੜੇ ਪ੍ਰੋਡਕਟ ਹੁੰਦੇ ਆ ਇਹ ਬਹੁਤ ਯੂਜਫੁਲ ਹੁੰਦੇ ਆ ਸਾਡੇ ਵਾਸਤੇ ਅਤੇ ਅਸੀਂ ਦੁਬਾਰਾ ਵੀ ਇਹਨਾਂ ਨੂੰ ਖਰੀਦਣਾ ਚਾਹਵਾਂਗੇ ਜੋ ਬਹੁਤ ਪੋਜੀਟਿਵ ਸਾਡੇ ਵਾਸਤੇ ਉਹਦਾ ਰਿਹਾ ਧੰਨਵਾਦ